ਸਤਿ ਸ਼੍ਰੀ ਅਕਾਲ ਵੀਰ ਜੀ ਟਰ ਸਰਦਾਰ ਟਰੈਵਲ ਏਜੈਂਸੀ ਤੋਂ ਬੋਲਦੇ ਹੋ ਜੀ ਅਤੇ ਮੈਂ ਇੱਕ ਨਾ ਤੇ ਚੰਡੀਗੜ੍ਹ ਜਾਣਾ ਸੀ ਅਤੇ ਉਹਦਾ ਬਾਰੇ ਪਤਾ ਕਰਨਾ ਸੀ ਅਤੇ ਕੀ ਰੇਟ ਨੇ ਅਸੀਂ ਪਰਿਵਾਰ ਸਮੇਤ ਘੁੰਮਣ ਜਾਣਾ ਅਤੇ ਕੋਈ ਡਰਾਈਵਰ ਚੰਗਾ ਹੋਵੇ ਸ਼ਰਾਬੀ ਨਾ ਹੋਵੇ ਅਤੇ ਉਹਦਾ ਦਾ ਛੋਟੀ ਗੱਡੀ ਦਾ ਕੀ ਚਾਰਜ ਆ ਅਤੇ ਵੱਡੀ ਗੱਡੀ ਦਾ ਕੀ ਚਾਰਜ ਆ ਅਤੇ ਉਹਦੇ ਦਾ ਖਾਣਾ ਪੀਣਾ ਵੱਖਰਾ ਜਾਂ ਸਾਡੇ ਵਿੱਚੇ ਆ ਸਭ ਕੁਛ ਮੈਨੂੰ ਦੱਸਦੇ ਵੀਰ ਬਣ ਕੇ ਕਿਵੇਂ ਕਿਵੇਂ ਹੈਗਾ ਇਹ ਅਤੇ ਅਸੀਂ ਪਰਿਵਾਰ ਆ ਸਾਡੇ ਨਾਲ ਅਸੀਂ ਨੇ ਜਾਣਾ ਹੈ ਘੁੰਮਣ ਅਤੇ ਉਹਨਾਂ ਨੂੰ ਦੱਸ ਦਿਉ ਕਿੰਨਾ ਪੈਸੇ ਲਵੋਂਗੇ ਕਿਵੇਂ ਕਿਵੇਂ ਕਰੋਂਗੇ ਕੀ ਆਪਣਾ ਚਾਰਜ ਹੋਊਗਾ ਥੈਂਕ ਯੂ ਵੀਰ ਜੀ